ਸਰਕਾਰੀ ਥਾਵਾਂ ਸਾਡੇ ਖੇਤਰ ਵਿੱਚ ਬਹੁਤ ਹੀ ਜ਼ਿਆਦਾ ਵਿਕਾਸ ਕਰਦੀਆਂ ਹਨ ਜਿਵੇਂ ਕਿ ਸਰਕਾਰੀ ਸਕੂਲਾਂ ਵਿੱਚ ਜਵਾਕਾਂ ਨੂੰ ਖੇਡਾਂ ਵਿੱਚ ਹਿੱਸੇ ਦਿਵਾਏ ਜਾਂਦੇ ਆ ਸਰਕਾਰੀ ਸਕੂਲਾਂ ਵਿੱਚ ਜ਼ਿਲ੍ਹਾ ਪੱਧਰ ਤੋਂ ਲੈ ਕੇ ਸਟੈਟ ਪੱਧਰ ਤੱਕ ਬਹੁਤ ਹੀ ਜਗ੍ਹਾ ਮੁਕਾਬਲਿਆਂ ਵਿੱਚ ਹਿੱਸੇ ਦਿਵਾਏ ਜਾਂਦੇ ਆ ਜੋ ਕਿ ਵਿਦਿਆਰਥੀ ਹਿੱਸੇ ਲੈਂਦੇ ਨੇ ਅਤੇ ਇਹ ਖੇਡਾਂ ਵਿੱਚ ਖੇਡਾਂ ਵਿੱਚ ਹਿੱਸੇ ਲੈਂਦੇ ਨੇ ਅਤੇ ਉਹਨਾਂ ਦੇ ਸਰੀਰ ਵਿੱਚ ਬਹੁਤ ਉਹਨਾਂ ਦਾ ਸਰੀਰ ਵੀ ਤੰਦਰੁਸਤ ਰਹਿੰਦਾ ਅਤੇ ਬਿਮਾਰੀਆਂ ਤੋਂ ਦੂਰ ਰਹਿੰਦਾ ਇਸ ਲਈ ਬਹੁਤ ਜ਼ਿਆਦਾ ਥਾਵਾਂ 'ਤੇ ਉਹਨਾਂ ਦੇ ਟੂਰਨਾਮੈਂਟ ਕਰਾਏ ਜਾਂਦੇ ਹਨ ਅਤੇ ਉਹਨਾਂ ਦੇ ਟੂਰਨਾਮੈਂਟ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟੂਰਨਾਮੈਂਟ ਵਿੱਚ ਉਹਨਾਂ ਦੇ ਹਿੱਸੇ ਹੁੰਦੇ ਨੇ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਸਰਕਾਰ ਵੱਲੋਂ ਇਨਾਮ ਵੀ ਦਿੱਤੀ ਜਾਂਦੇ ਨੇ ਅਤੇ ਖੇਡਾਂ ਵਾਲੇ ਜਵਾਕਾਂ ਨੂੰ ਉਹਨਾਂ ਦੀਆਂ ਖੇਡਾਂ ਫੁੱਟਬਾਲਾਂ ਵਗੈਰਾ ਅਤੇ ਵਰਦੀਆਂ ਵੀ ਦਿੱਤੀਆਂ ਜਾਂਦੀਆਂ ਨੇ ਅਤੇ ਸਰਕਾਰੀ ਸਰਕਾਰੀ ਜ਼ਿੰਮਾਂ ਵੀ ਹਨ ਜੋ ਕਿ ਬੱਚਿਆਂ ਨੂੰ ਜ਼ਿੰਮਾਂ ਵਿੱਚ ਜੋ ਕਿ ਬੱਚੇ ਜਿੰਮਾਂ ਵਿੱਚ ਵੀ ਜਾਂਦੇ ਹਨ ਅਤੇ ਉਹਨਾਂ ਦੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਜ਼ਿੰਮਾਂ ਵਿੱਚ ਜਾ ਕੇ ਸਰੀਰ ਤੰਦਰੁਸਤ ਰਹਿੰਦਾ ਅਤੇ ਬਹੁਤ ਬਿਮਾਰੀਆਂ ਤੋਂ ਵੀ ਦੂਰ ਹੀ ਰਹਿੰਦੇ ਅਤੇ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਅਤੇ ਖੇਡਾਂ ਵਿੱਚ ਵੀ ਬਲ ਬਹੁਤ ਜ਼ਿਆਦਾ ਫਿਰ ਹਿੱਸਾ ਲੈ ਲੈਂਦੇ ਨੇ ਅਤੇ ਬੱਚੇ ਆਪਣੇ ਸਕੂਲ ਦਾ ਅਤੇ ਪਿੰਡ ਦਾ ਅਤੇ ਆਪਣਾ ਅਤੇ ਮਾਪਿਆਂ ਦਾ ਨਾਮ ਵੀ ਰੋਸ਼ਨ ਕਰਦੇ ਹਨ